ਹਾਂਜੀ ਮੈਨੂੰ ਲੱਗਦਾ ਹੈ ਕਿ ਸਕੂਲਾਂ ਵਿੱਚ ਵਧੇਰੇ ਕਿੱਤਾ ਮੁਖੀ ਸਿੱਖਿਆ ਜਿਵੇਂ ਤਰਖਾਣ ਪਲੰਬਿੰਗ ਸਿਖਲਾਈ ਪੋਲਟਰੀ ਅਤੇ ਪਸ਼ੂ ਪਾਲਣ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਜ਼ਿਆਦਾ ਪੋਲਟਰੀ ਫਾਰਮ ਹੀ ਖੋਲ੍ਹੇ ਹੋਏ ਹਨ ਕਿਉਂਕਿ ਨੌਕਰੀ ਤਾਂ ਕਿਸੇ ਨੂੰ ਮਿਲਦੀ ਨਹੀਂ ਅਤੇ ਲੋਕ ਇਹਨਾਂ ਚੀਜ਼ਾਂ ਵਿੱਚ ਜ਼ਿਆਦਾ ਆਪਣਾ ਧਿਆਨ ਦੇ ਰਹੇ ਹਨ ਅਤੇ ਇਹਨਾਂ 'ਚ ਆਪਣਾ ਕਰੀਅਰ ਬਣਾ ਰਹੇ ਹਨ ਅਤੇ ਮੋਟੀ ਕਮਾਈ ਕਰਦੇ ਹਨ ਇਹਨਾਂ ਦੇ ਨਾਲ ਇੱਕ ਤਾਂ ਆਪਾਂ ਨੂੰ ਚਲੋ ਪੈਸਿਆਂ ਦਾ ਤਾਂ ਹੁੰਦਾ ਹੀ ਹੁੰਦਾ ਹੈ ਕਿ ਪੈਸੇ ਆਪਾਂ ਨੂੰ ਵਧੇਰੇ ਮਿਲਦੇ ਹਨ ਅਤੇ ਦੂਜਾ ਪਸ਼ੂਆਂ ਨਾਲ ਪਿਆਰ ਵੱਧਦਾ ਹੈ ਅਤੇ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਪਸ਼ੂ ਕਿਵੇਂ ਰਹਿੰਦੇ ਹਨ ਅਤੇ ਕਿਵੇਂ ਵਰਤਾਓ ਕਰਦੇ ਹਨ ਉਹਨਾਂ ਨੂੰ ਕੀ ਕੀ ਜ਼ਰੂਰੀ ਹੈ ਕੀ ਕੀ ਉਹਨਾਂ ਨੂੰ ਦੇਣਾ ਚਾਹੀਦਾ ਹੈ ਅਤੇ ਅੱਜ ਕੱਲ੍ਹ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਈਆਂ ਨਹੀਂ ਜਾਂਦੀਆਂ ਵੈਸੇ ਜ਼ਿਆਦਾਤਰ ਕਿਉਂਕਿ ਲੋਕਾਂ ਨੂੰ ਸਿਰਫ਼ ਜੋਬ ਵਾਲੇ ਪਾਸੇ ਹੀ ਧੱਕਿਆ ਜਾਂਦਾ ਹੈ ਕਿ ਕਈ ਵਾਰੀ ਬੰਦੇ ਨੂੰ ਨੌਕਰੀ ਨਹੀਂ ਮਿਲਦੀ ਅਤੇ ਉਹ ਆਪਣਾ ਕੰਮ ਵੀ ਤਾਂ ਕਰਨਾ ਉਹਨੂੰ ਆਉਣਾ ਚਾਹੀਦਾ ਹੈ ਅਤੇ ਇਹ ਚੀਜ਼ਾਂ ਜ਼ਰੂਰੀ ਹਨ ਪਲੰਬਿੰਗ ਵਿੱਚ ਅੱਜ ਕੱਲ੍ਹ ਜੇ ਬੰਦਾ ਬਾਹਰਲੀ ਕੰਟਰੀ ਵਿੱਚ ਜਾਂਦਾ ਹੈ ਜਾਂ ਵਿਦੇਸ਼ ਵਿੱਚ ਜਾਂਦਾ ਹੈ ਉੱਥੇ ਬੰਦੇ ਨੂੰ ਜ਼ਿਆਦਾ ਇਸ ਚੀਜ਼ ਵਿੱਚ ਫਾਇਦਾ ਹੁੰਦਾ ਹੈ ਕਿਉਂਕਿ ਉੱਥੇ ਪਲੰਬਿੰਗ ਦਾ ਕੰਮ ਆਮ ਹੈ ਅਤੇ ਲੋਕ ਇਹ ਇਜੀਲੀ ਕਰ ਸਕਦੇ ਹਨ ਸੌਖੇ ਤਰੀਕੇ ਨਾਲ ਕਰ ਸਕਦੇ ਹਨ